ਹੈਲੋ ਭਾਅ ਜੀ ਸਲੂਨ ਤੋਂ ਬੋਲਦੇ ਤੁਸੀਂ ਭਾਅ ਜੀ ਮੈਂ ਬਾਲ ਜੇ ਥੋੜ੍ਹੇ ਸੈਟਿੰਗ ਜੇ ਕਰਾਣੇ ਸੀਗੇ ਹਾਂਜੀ ਤੁਸੀਂ ਮਤਲਬ ਕਿੱਦਾਂ ਕਿੱਦਾਂ ਦੇ ਕਰਦੇ ਅੱਜ ਦੇ ਟਾਈਮ 'ਚ ਤਾਂ ਤੁਹਾਨੂੰ ਪਤਾ ਏ ਨਵੇਂ ਨਵੇਂ ਟਰੈਂਡ ਚੱਲਦੇ ਤੁਹਾਨੂੰ ਤੁਸੀਂ ਦੱਸੋ ਕਿੱਦਾਂ ਜੇ ਮਤਲਬ ਵਧੀਆ ਕਰ ਸਕਦੇ ਆ

ਮੇਰੇ ਬਾਲ ਭਾਅ ਜੀ ਲੰਬੇ ਹੈ ਅਤੇ ਉਹਦੇ 'ਤੇ ਫਿਰ ਕਿੱਦਾਂ ਦੇ ਬਾਲ ਸੂਟ ਕਰੂੰਗੇ ਮੇਰੇ 'ਤੇ ਅੱਛਾ ਜੀ ਅਤੇ ਕੇਰਾਟਿਨ 'ਚ ਫਿਰ ਕਿਆ ਮਤਲਬ ਕਿੱਦਾਂ ਹੁੰਦਾ ਇਹ ਕੇਰਾਟਿਨ 'ਚ

ਅੱਛਾ ਜੀ

ਅੱਛਾ ਜੀ ਅੱਛਾ ਜੀ ਅੱਛਾ ਭਾਅ ਜੀ ਅਤੇ ਇਹਦਾ ਪ੍ਰਾਈਜ਼ ਕੀ ਹੈ ਭਾਅ ਜੀ ਅੱਛਾ ਜੀ ਅਤੇ ਫਿਰ ਮਤਲਬ ਮੈਂ ਸੰਡੇ ਨੂੰ ਦੁਕਾਨ ਖੁੱਲ੍ਹੀ ਹੋਵੇਗੀ ਤੁਹਾਡੀ ਮੈਂ ਉਹੀ ਗਿਆਰ੍ਹਾਂ ਬਾਰ੍ਹਾਂ ਵਜੇ ਤੱਕ ਆਊਂਗਾ ਭਾਅ ਜੀ ਤੁਹਾਡੇ ਕੋਲ ਸੰਡੇ ਨੂੰ ਹਾਂਜੀ ਠੀਕ ਹੈ ਭਾਅ ਜੀ ਅਤੇ ਨਾਲੇ ਤੁਸੀਂ ਮੈਨੂੰ ਆਪਣੀ ਨਾ ਲੋਕੇਸ਼ਨ ਭੇਜ ਦਿਉ ਆਹੀ ਨੰਬਰ 'ਤੇ ਮੈਨੂੰ ਵਟਸਐਪ 'ਤੇ ਹਾਂਜੀ ਹਾਂਜੀ ਲੋਕੇਸ਼ਨ ਮੈਨੂੰ ਭੇਜ ਦਿਓ ਬਾਕੀ ਮੈਂ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਕਰ ਦੂੰਗਾ ਪਹਿਲਾਂ ਹਾਂਜੀ ਹਾਂਜੀ ਪਤਾ ਮੈਨੂੰ ਹਾਂਜੀ ਹਾਂਜੀ ਠੀਕ ਹੈ ਭਾਅ ਜੀ ਸੰਡੇ ਨੂੰ ਮਿਲਦੇ ਹਾਂ ਫਿਰ ਓਕੇ ਓਕੇ ਭਾਅ ਜੀ ਥੈਂਕ ਯੂ